ਸਪਰੇਹਾਂ ਬਾਰੇ ਜੀ ਅਤੇ ਕਿਆ ਕਹਿਨੇ ਸਪਰੇਅ ਗੋਬਰ ਗੈਸ ਗੋਬਰ ਗੈਸ ਪਹਿਲਾਂ ਪੁਰਾਣੇ ਸਮੇਂ ਵਿੱਚ ਗੋਬਰ ਗੈਸ ਦੀ ਵਰਤੋਂ ਕੀਤੀ ਜਾਂਦੀ ਸੀ ਜਿਵੇਂ ਪੱਤੇ ਹੋ ਗਏ ਜੀ ਜਿਵੇਂ ਕੋਈ ਕੂੜਾ ਕਵਾੜ ਹੋ ਜਾਂਦਾ ਘਰ ਦਾ ਹੋ ਜਾਂਦਾ ਸੀ ਜਿਵੇਂ ਸਬਜ਼ੀਆਂ ਦਾ ਕੱਟਿਆ ਕੁਟਿਆ ਵਾ ਆਪਾਂ ਟੋਆ ਪੱਟ ਕੇ ਰੱਖ ਦਿੰਦੇ ਸੀ ਉਹ ਖਾਦ ਤਿਆਰ ਹੋ ਜਾਂਦੀ ਤੀ ਅਤੇ ਆਪਾਂ ਪਾਣੀ 'ਚ ਮਿਲਾ ਕੇ ਜੀ ਪਾਣੀ ਵਿੱਚ ਮਿਲਾ ਕੇ ਨਾ ਉਹਨੂੰ ਖੇਤਾਂ ਵਿੱਚ ਦਿੰਦੇ ਸੀ ਜਿਵੇਂ ਘਰਾਂ ਆਪਾਂ ਪਾਲਕ ਬੀਜ ਬੀਜ ਲੈਂਦੇ ਸਾਗ ਬੀਜ ਲੈਂਦੇ ਅਤੇ ਜੀ ਉਹਨਾਂ ਨੂੰ ਦੇ ਦਿੰਦੇ ਸੀ ਉਹ ਖਾਦ ਖਾਦ ਪਾ ਦਿੰਦੇ ਸੀ ਵਿੱਚ ਅਤੇ ਫ਼ਸਲ ਵੀ ਬਹੁਤ ਵਧੀਆ ਹੁੰਦੀ ਸੀ ਅਤੇ ਅੱਜ ਦੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਸਪਰੇਹਾਂ ਰੇਅ ਯੂਰੀਆ ਲੋਕ ਵਰਤਣ ਲੱਗ ਗਏ ਆਪਣੇ ਸਰੀਰ ਵਾਸਤੇ ਵੀ ਬਹੁਤ ਨਾਜ਼ੁਕ ਹਨ ਬਹੁਤ ਘਟੀਆ ਚੀਜ਼ਾਂ ਹਨ ਅਤੇ ਬਿਮਾਰੀਆਂ ਤਾਂ ਹੀ ਆਪਾਂ ਏਨੀਆਂ ਬਿਮਾਰੀਆਂ ਹਾਰਟ ਅਟੈਕ ਆ ਰਿਹਾ ਦਵਾਈਆਂ ਸਪਰੇਹਾਂ ਕਰਕੇ ਜੇ ਜਦੋਂ ਪੁਰਾਣੇ ਸਮੇਂ ਵਿੱਚ ਕਰਦੇ ਸੀ ਬੰਦੇ ਕੰਮ ਵੀ ਵਧੀਆ ਕਰਦੇ ਸੀ ਅਤੇ ਖੇਤਾਂ ਵਿੱਚ ਸਾਹ ਦੀ ਪ੍ਰੋਬਲਮ ਹੁਣ ਦੇਖੋ ਕਿੰਨੀ ਆ ਰਹੀ ਹੈ ਜੀ ਉਹਦੇ ਕਰਕੇ ਦਿੱਕਤ ਇੰਨੀ ਆ ਰਹੀ ਬਿਮਾਰੀਆਂ ਵੱਧ ਤੋਂ ਵੱਧ ਵੱਧ ਰਹੀਆਂ ਜੇ ਆਪਾਂ ਪੁਰਾਣਾ ਸਮਾਂ ਮੁੜ ਦੁਬਾਰਾ ਲਿਆਈਏ ਜੀ ਤਾਂ ਬਹੁਤ ਵਧੀਆ ਲੱਗੂਂਗਾ ਜੀ ਜੇ ਸਪਰੇਆਂ ਦੀ ਵਰਤੋਂ ਆਪਾਂ ਨਾ ਕਰੀਏ ਗੋਬਰ ਗੈਸ ਤਿਆਰ ਕਰਕੇ ਖੇਤਾਂ ਵਿੱਚ ਪਾਈਏ ਹੁਣ ਵੀ ਚਲੋ ਕੁਝ ਕੁਝ ਨਹੀਂ ਹੋਇਆ ਵਧੀਆ ਤਰੀਕੇ ਨਾਲ਼ ਵੀ ਆਪਾਂ ਆਪਣੇ ਸਰੀਰ ਦੀ ਸਾਂਭ ਕਰ ਸਕਦੇ ਹਾਂ